ਅੱਜ ਭਾਰਤ ਵਿੱਚ ਸਰਕਾਰਾਂ ਅੱਗੇ ਸਭ ਤੋਂ ਮਹੱਤਵਪੂਰਨ ਚੁਣੌਤੀਆਂ ਇਹ ਹਨ ਕਿ ਸਾਡੇ ਦੇਸ਼ ਵਿੱਚ ਜਿੰਨੇ ਵੀ ਸਰਕਾਰੀ ਸਕੂਲ ਹਨ ਜਾਂ ਪ੍ਰਾਈਵੇਟ ਸਕੂਲ ਹਨ ਪ੍ਰਾਈਵੇਟ ਦੀ ਚਲੋ ਆਪਾਂ ਗੱਲ ਨਹੀਂ ਕਰਦੇ ਸਰਕਾਰੀ ਸਕੂਲ ਜਿੰਨੇ ਵੀ ਹਨ ਉਹਨਾਂ ਵਿੱਚ ਪੜ੍ਹਾਈ ਦਾ ਸਿਸਟਮ ਕਿਸੇ ਕਿਸੇ ਸਕੂਲ ਵਿੱਚ ਵਧੀਆ ਹੁੰਦਾ ਹੈ ਅਤੇ ਕਿਸੇ ਵਿੱਚ ਮਾੜਾ ਹੁੰਦਾ ਹੈ ਉਹ ਕਿਵੇਂ ਕਈ ਸਕੂਲਾਂ ਦੇ ਬੱਚੇ ਨਹੀਂ ਸਹੀ ਹੁੰਦੇ ਕਈ ਸਕੂਲਾਂ ਦੇ ਟੀਚਰ ਨਹੀਂ ਸਹੀ ਹੁੰਦੇ ਜੇ ਟੀਚਰ ਕੋਈ ਵੀ ਗੱਲ ਸਮਝਾ ਰਿਹਾ ਤੋ ਆਪਣਾ ਬਸ ਉਹ ਲੈਕਚਰ ਲਗਾ ਕੇ ਉੱਥੋਂ ਤੁਰਨ ਦੀ ਕਰਦਾ ਹੈ ਅਤੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚੇ ਵੀ ਨਹੀਂ ਸਹੀ ਤਰ੍ਹਾਂ ਪੜ੍ਹ ਪਾਉਂਦੇ ਬੱਚਿਆਂ ਨੂੰ ਫਰੀਡਮ ਮਿਲ ਜਾਂਦੀ ਆ ਇਸ ਚੀਜ਼ ਦੀ ਕਿ ਚਲੋ ਸਰ ਨਹੀਂ ਪੜ੍ਹਾ ਰਿਹਾ ਤਾਂ ਆਪਾਂ ਵੀ ਨਹੀਂ ਪੜ੍ਹਨਾ ਪਰ ਇਸ ਚੀਜ਼ ਦਾ ਬੱਚਿਆਂ ਨੂੰ ਅੱਗੇ ਜਾ ਕੇ ਜਦੋਂ ਵੀਹ ਸਾਲ ਦੀ ਉਮਰ ਤੋਂ ਜਾਂ ਪੱਚੀ ਸਾਲ ਦੀ ਉਮਰ ਤੋਂ ਅੱਗੇ ਵੱਧਦੇ ਹਨ ਉਸ ਤੋਂ ਬਾਅਦ ਉਹਨਾਂ ਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਸਾਨੂੰ ਸਹੀ ਸਕੂਲੇ ਨਹੀਂ ਪੜ੍ਹਾਇਆ ਗਿਆ ਜਾਂ ਸਹੀ ਅਧਿਆਪਕ ਨਹੀਂ ਟੱਕਰੇ ਸਾਨੂੰ ਇਸ ਚੀਜ਼ ਵੱਲ ਸਰਕਾਰ ਨੂੰ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਕਿ ਹਰ ਇੱਕ ਟੀਚਰ ਹਰ ਇੱਕ ਸਕੂਲ ਵਿੱਚ ਹਰ ਇੱਕ ਵਿਦ ਅਧਿਆਪਕ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਕਿ ਉਹ ਕਿੱਦਾਂ ਪੜ੍ਹਾ ਰਿਹਾ ਹੈ ਬੱਚਿਆਂ ਨੂੰ ਅਤੇ ਅੱਗੋਂ ਬੱਚੇ ਵੀ ਵਧੀਆ ਤਰੀਕੇ ਨਾਲ ਪੜ੍ਹਾਈ ਕਰਨ